ਪੰਜਾਬੀ ਭਾਸ਼ਾ ਹੈਗੀ ਆ ਜਿਹੜੀ ਸਾਡੀ ਮਾਂ ਬੋਲੀ ਹੈ ਇਹ ਬਹੁਤ ਸਰਲ ਅਤੇ ਸੌਖੀ ਭਾਸ਼ਾ ਇਹਨੂੰ ਗੁਰਮੁਖੀ ਭਾਸ਼ਾ ਵੀ ਕਹਿੰਦੇ ਆ ਇਸ ਨੂੰ ਬੋਲਣਾ ਬਹੁਤ ਸੌਖਾ ਹੈ ਆਮ ਬੱਚਾ ਵੀ ਉਸਨੂੰ ਸਿੱਖ ਲੈਂਦਾ ਹੈ ਇਹ ਜ਼ਿਆਦਾਤਰ ਆਪਣੇ ਘਰ ਪਰਿਵਾਰ ਵਿੱਚ ਸਿੱਖ ਲੈਂਦੇ ਹੈਗੇ ਆ ਫਿਰ ਆਪਦੇ ਸਕੂਲ ਵਿੱਚ ਜਾ ਕੇ ਸਿੱਖ ਲੈਂਦੇ ਆ ਜਿਹੜੇ ਸਾਡੇ ਦਸ ਗੁਰੂਆਂ ਨੇ ਉਹਨਾਂ ਨੇ ਆਪਣੇ ਗ੍ਰੰਥ ਪੰਜਾਬੀ ਭਾਸ਼ਾ ਵਿੱਚ ਲਿਖੇ ਆ ਯੂਪੀ ਬਿਹਾਰ ਦੇ ਲੋਕ ਵੀ ਇੱਥੇ ਆ ਕੇ ਪੰਜਾਬੀ ਬੋਲਣਾ ਸਿੱਖ ਗਏ ਨੇ ਇਹ ਸਾਡੀ ਸੱਭਿਆਚਾਰਕ ਭਾਸ਼ਾ ਬਣ ਗਈ ਹੈ ਪੰਜਾਬੀ ਭਾਸ਼ਾ ਇੰਨੀ ਸੌਖੀ ਆ ਕਿ ਇਸ ਨੂੰ ਬਾਹਰਲਾ ਬੰਦਾ ਵੀ ਸਮਝ ਲੈਂਦਾ ਇਸ ਇਸ ਲਈ ਮੇਰਾ ਅਨੁਭਵ ਕਹਿੰਦਾ ਹੈ ਕਿ ਪੰਜਾਬੀ ਭਾਸ਼ਾ ਬਹੁਤ ਹੀ ਸੌਖੀ ਅਤੇ ਸਰਲ ਹੈਗੀ ਹੈ